ਮੈਨੂੰ ਹਾਈਕ ਕਰਨ ਦੇ ਲਈ ਜੰਗਲ ਅਤੇ ਪਹਾੜ ਕਾਫ਼ੀ ਜ਼ਿਆਦਾ ਪਸੰਦ ਹਨ ਮੈਂ ਹਾਈਕਿੰਗ ਦੇ ਲਈ ਇੱਕ ਵਾਰ ਮੇਰੇ ਦੋਸਤ ਦੇ ਨਾਲ਼ ਦੇਹਰਾਦੂਨ ਗਿਆ ਸੀ ਦੇਹਰਾਦੂਨ ਦੇ ਵਿੱਚ ਕਾਫ਼ੀ ਜ਼ਿਆਦਾ ਪਹਾੜ ਹਨ ਅਤੇ ਸੰਘਣੇ ਜੰਗਲ ਹਨ ਉਹਨਾਂ ਦੇ ਵਿੱਚੋਂ ਜਿਹੜੇ ਜੰਗਲਾਂ ਦੇ ਵਿੱਚ ਜੰਗਲੀ ਜਾਨਵਰ ਨਹੀਂ ਸਨ ਮੈਂ ਅਤੇ ਮੇਰੇ ਦੋਸਤਾਂ ਨੇ ਉੱਥੇ ਹਾਈਕਿੰਗ ਕਰਨ ਦਾ ਪਲੈਨ ਬਣਾਇਆ ਸੀ ਅਤੇ ਅਸੀਂ ਉੱਥੇ ਹਾਈਕਿੰਗ ਕਰਨ ਦੇ ਲਈ ਅਗਸਤ ਮਹੀਨੇ ਦੇ ਵਿੱਚ ਗਏ ਸੀ ਅਸੀਂ ਉਸ ਸੰਘਣੇ ਜੰਗਲ ਦੇ ਵਿੱਚ ਗਏ ਬਹੁਤ ਹੀ ਜ਼ਿਆਦਾ ਸੰਘਣਾ ਜੰਗਲ ਸੀ ਅਤੇ ਸਾਨੂੰ ਉੱਥੇ ਜੋ ਜਾਨਵਰ ਹਾਨੀਕਾਰਕ ਨਹੀਂ ਹਨ ਮਤਲਬ ਕਿ ਮਾਸਾਹਾਰੀ ਨਹੀਂ ਹਨ ਜੋ ਮਨੁੱਖਾਂ 'ਤੇ ਹਮਲਾ ਨਹੀਂ ਕਰਦੇ ਉਹ ਸਨ ਅਸੀਂ ਉਹਨਾਂ ਨੂੰ ਦੇਖਿਆ ਜਿਵੇਂ ਕਿ ਹਿਰਨ ਯਾਕ ਵਗੈਰਾ ਅਤੇ ਉੱਥੇ ਬਹੁਤ ਹੀ ਸੋਹਣੇ ਸੋਹਣੇ ਪੰਛੀ ਸਨ ਜੋ ਦੇਖਣ ਦੇ ਵਿੱਚ ਅਤੇ ਉਹਨਾਂ ਦੀਆਂ ਆਵਾਜ਼ਾਂ ਸੁਣਨ ਦੇ ਵਿੱਚ ਦਿਲ ਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਅਤੇ ਇਸ ਤੋਂ ਇਲਾਵਾ ਮੈਂ ਇੱਕ ਵਾਰ ਗੁੱਲ ਮਰਗ ਦੇ ਵਿੱਚ ਪਹਾੜਾਂ 'ਤੇ ਵੀ ਹਾਈਕਿੰਗ ਕਰਨ ਦੇ ਲਈ ਗਿਆ ਸੀ ਉਹ ਵੀ ਤਜ਼ਰਬਾ ਬਹੁਤ ਹੀ ਜ਼ਿਆਦਾ ਸੋਹਣਾ ਸੀ